ਅਸੀਂ ਆਪਣੀ ਜ਼ਿੰਦਗੀ ਵਿੱਚ ਬਹੁਤ ਸਾਰੇ ਉਪਕਰਨਾਂ ਦੀ ਵਰਤੋਂ ਕਰਦੇ ਹਾਂ ਇਹ ਸਾਰੇ ਨਵੀਂ ਟੈਕਨੋਲਜੀ ਨਾਲ ਹੀ ਸੰਬੰਧਿਤ ਹਨ ਜਿਵੇਂ ਗੈਸ ਚੁੱਲ੍ਹਾ ਅਗਰ ਗੈਸ ਚੁੱਲ੍ਹਾ ਉਪਕਰਨ ਨਾ ਹੋਵੇ ਤਾਂ ਸਾਡੀ ਜ਼ਿੰਦਗੀ ਅੱਗ 'ਤੇ ਚੁੱਲ੍ਹਿਆਂ 'ਤੇ ਦੂਜੀ ਲੱਕੜ ਬਾਲ ਕੇ ਤੇ ਰੋਟੀ ਬਣਾਉਣੀ ਪਵੇਗੀ ਇਹਨਾਂ ਨਾਲ ਸਾਡੀ ਜ਼ਿੰਦਗੀ ਵਿੱਚ ਇੱਕ ਤਾਂ ਟਾਈਮ ਬਚਦਾ ਹੈ ਦੂਜੀ ਗੱਲ ਸਾਡੀ ਜ਼ਿੰਦਗੀ ਵਿੱਚ ਇਹ ਉਪਕਰਨ ਨਾ ਹੋਣ ਤਾਂ ਅਸੀਂ ਆਪਣੇ ਆਪ ਨੂੰ ਬਹੁਤ ਹੀ ਐਵੇਂ ਫੀਲ ਕਰਦੇ ਹਾਂ ਕਿ ਅਸੀਂ ਤਾਂ ਕੋਈ ਕੰਮ ਹੀ ਨਹੀਂ ਕਰ ਸਕਦੇ ਅਸੀਂ ਆਪਣੀ ਜ਼ਿੰਦਗੀ ਵਿੱਚ ਮਾਈਕਰੋਵੇਵ ਓਵਨ ਦੀ ਵਰਤੋਂ ਸ਼ੁਰੂ ਕਰ ਲਈ ਅਗਰ ਇਹ ਨਾ ਹੋਵੇ ਆਪਾਂ ਕਹਿੰਦੇ ਹਾਂ ਸਬਜ਼ੀ ਗਰਮ ਕਿਵੇਂ ਕਰੀਏ ਭਾਂਡੇ ਲੱਗਣਗੇ ਅਸੀਂ ਆਪਣੀ ਜ਼ਿੰਦਗੀ ਵਿੱਚ ਕੋਲੇ ਵਾਲੀ ਪ੍ਰੈਸ ਦੀ ਬਜਾਏ ਬਿਜਲੀ ਵਾਲੀ ਦੀ ਵਰਤੋਂ ਸ਼ੁਰੂ ਕਰ ਲਈ ਅਸੀਂ ਪਾਣੀ ਗਰਮ ਨਹਾਉਣ ਲਈ ਕਰਦੇ ਸੀ ਅੱਗੇ ਤਾਂ ਲੱਕੜਾਂ ਬਾਲ ਕੇ ਪਾਣੀ ਗਰਮ ਕਰਦੇ ਸੀ ਹੁਣ ਆਪਣੇ ਘਰਾਂ ਵਿੱਚ ਗੀਜ਼ਰ ਲੱਗ ਗਏ ਨੇ ਜਿਹਦੇ ਨਾਲ ਆਪਣੇ ਟਾਈਮ ਦੀ ਵਰਤੋਂ ਵੀ ਬਹੁਤ ਘੱਟ ਗਈ ਹੈ ਆਪਣਾ ਟਾਈਮ ਬਹੁਤ ਬਚਦਾ ਹੈ ਆਪਾਂ ਦੀ ਜ਼ਿੰਦਗੀ ਵਿੱਚ ਅੱਗੇ ਤੋਰੀ ਸੋਟੇ ਨਾਲ ਚਟਨੀ ਕੁੱਟ ਕੇ ਬਣਾ ਕੇ ਖਾਂਦੇ ਸੀ ਹੁਣ ਆਪਾਂ ਮਿਕਸੀ ਦੀ ਵਰਤੋਂ ਸ਼ੁਰੂ ਕਰ ਲਿੱਤੀ ਹੈ ਉਹਦੇ ਵਿੱਚ ਚਟਨੀ ਬਣਾਓ ਤਾਂ ਦੋ ਮਿੰਟ ਲੱਗਦੇ ਹਨ ਅਤੇ ਦੋਰੀ ਸੋਟੇ ਵਿੱਚ ਬਣਾਉਂਦੇ ਸੀ ਤਾਂ ਆਪਾਂ ਪੰਦਰਾਂ ਮਿੰਟ ਲੱਗ ਜਾਂਦੇ ਸੀ ਅੱਜ ਕੱਲ੍ਹ ਆਪਾਂ ਮਿਕਸੀ ਦੀ ਵਰਤੋਂ ਵੀ ਬਹੁਤ ਕਰਨ ਲੱਗ ਗਏ ਹਾਂ ਆਪਣਾ ਇਸ ਨਾਲ ਟਾਈਮ ਵੀ ਬਹੁਤ ਬਚਦਾ ਹੈ ਆਪਣੀ ਜ਼ਿੰਦਗੀ ਅਸੀਂ ਆਪ ਹੀ ਕਰ ਰਹੇ ਹਾਂ ਆਪਣੇ ਆਪ ਨੂੰ ਕੰਮ ਚੋਰ ਸਾਡੀ ਜ਼ਿੰਦਗੀ ਦਾ ਇਸ ਤਰਾਂ ਹੋ ਗਈ ਹੈ ਕਿ ਉਪਕਰਨ ਨਾ ਹੁੰਦੇ ਤਾਂ ਅਸੀਂ ਤਾਂ ਵੇਹਲੇ ਬਹਿ ਹੀ ਨਹੀਂ ਸਕਦੇ ਸੀ ਅੱਜ ਕੱਲ੍ਹ ਤਾਂ ਉਹ ਸਭ ਤੋਂ ਜ਼ਿਆਦਾ ਫੋਨ ਦੀ ਵਰਤੋਂ ਸ਼ੁਰੂ ਹੋ ਗਈ ਹੈ ਅੱਗੇ ਤਾਂ ਫੋਨ ਹੁੰਦੇ ਹੀ ਨਹੀਂ ਸੀ ਉਦੋਂ ਤਾਂ ਚਿੱਠੀ ਪੱਤਰ ਇਸ ਚੀਜ਼ਾਂ ਦੀ ਵਰਤੋਂ ਹੁੰਦੀ ਸੀ ਅੱਜ ਕੱਲ੍ਹ ਫੋਨ ਫੋਨ 'ਤੇ ਆਪਾਂ ਘਰ ਬੈਠੇ ਹੀ ਜਿਸ ਨਾਲ ਮਰਜੀ ਗੱਲਬਾਤ ਕਰ ਲਈਏ ਜਿਸ ਨਾਲ ਮਰਜੀ ਆਪਾਂ ਵੀਡੀਓ ਕਾਲਿੰਗ ਕਰਕੇ ਗੱਲ ਕਰ ਸਕਦੇ ਹਾਂ ਇੱਕ ਦੂਜੇ ਨੂੰ ਆਮਣੇ ਸਾਹਮਣੇ ਬਹਿ ਕੇ ਕਰ ਲੈਂਦੇ ਹਾਂ ਦੂਰ ਦੂਰ ਦੇਸ਼ ਵਿਦੇਸ਼ ਜਿੱਥੇ ਮਰਜੀ ਚਲੇ ਜਾਓ ਉਸ ਤੋਂ ਵੀ ਆਪਾਂ ਨੂੰ ਸੌਖਾ ਹੋ ਗਿਆ ਉਹਨਾਂ ਨੂੰ ਵੀਡੀਓ ਕਾਲਿੰਗ ਕਰੋ ਇੰਟਰਨੈਟ ਚੱਲ ਪਿਆ ਹੈ ਆਪਾਂ ਆਪਣੇ ਲੈਪਟੋਪ ਤੋਂ ਵੀ ਉਹਨਾਂ ਨਾਲ ਗੱਲ ਕਰ ਸਕਦੇ ਹਾਂ ਮੋਬਾਈਲ ਫੋਨ 'ਤੇ ਵੀ ਕਰ ਸਕਦੇ ਹਾਂ ਅੱਜ ਕੱਲ੍ਹ ਤਾਂ ਆਪਾਂ ਨੂੰ ਇੱਕ ਤਾਂ ਗੂਗਲ ਪੇ ਚੱਲ ਗਿਆ ਇੱਕ ਪੇਟੀਐਮ ਚੱਲ ਗਏ ਗੁਗਲ ਪੇ ਕਰੋ ਇੱਕ ਦੂਜੇ ਨੂੰ ਪੈਸੇ ਪਹੁੰਚ ਜਾਂਦੇ ਹਨ ਅੱਗੇ ਆਪਾਂ ਮਨੀ ਆਰਡਰ ਦੁਆਰਾ ਪੈਸੇ ਭਿਜਵਾਉਂਦੇ ਸੀ ਆਪਾਂ ਨੂੰ ਤਾਂ ਬਹੁਤ ਵਧੀਆ ਹੋ ਗਿਆ ਹੁਣ ਇਹਨਾਂ ਦੇ ਫਾਇਦੇ ਵੀ ਹਨ ਅਤੇ ਨੁਕਸਾਨ ਵੀ ਬਹੁਤ ਹਨ ਇਸ ਨਾਲ ਆਪਾਂ ਆਪਣੇ ਆਪ ਨੂੰ ਸੌਖਾ ਫੀਲ ਕਰ ਲੈਂਦੇ ਹਾਂ